ਮੇਰੇ ਲਈ ਚਿੱਤਰਕਾਰੀ ਕਰਨਾ ਮੇਰਾ ਸ਼ੌਕ ਹੀ ਨਹੀਂ ਮੇਰਾ ਕਿੱਤਾ ਵੀ ਹੈ ਕੋਈ ਵੀ ਤਸਵੀਰ ਜਾਂ ਕਾਲਪਨਿਕ ਚੀਜ਼ ਨੂੰ ਬਣਾਉਣ ਵਿੱਚ ਸ਼ੁਰੂ ਵਿੱਚ ਬਹੁਤ ਸੋਚਣਾ ਪੈਂਦਾ ਹੈ ਪਰ ਜਦੋਂ ਜਦੋਂ ਇਸ ਨੂੰ ਮੈਂ ਬਣਾਉਣਾ ਸ਼ੁਰੂ ਕਰਦੀ ਹਾਂ ਤਾਂ ਮੁਸ਼ਕਲਾਂ ਆਪਣੇ ਆਪ ਦੂਰ ਹੁੰਦੀਆਂ ਜਾਂਦੀਆਂ ਹਨ ਇਤਿਹਾਸਕ ਅਤੇ ਸੱਭਿਆਚਾਰਕ ਤਸਵੀਰਾਂ ਬਣਾਉਣ ਵਿੱਚ ਬਹੁਤ ਔਖੀਆਂ ਹੁੰਦੀਆਂ ਹਨ ਕਿਉਂਕਿ ਇਹਨਾਂ ਨੂੰ ਬਣਾਉਣ ਦੇ ਲਈ ਬਹੁਤ ਅਭਿਆਸ ਕੀਤਾ ਜਾਂਦਾ ਹੈ ਤਾਂ ਕਿ ਜਦੋਂ ਇਹ ਤਸਵੀਰਾਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਜਾਣ ਤਾਂ ਉਹਨਾਂ ਨੂੰ ਇਹ ਦੇਖ ਕੇ ਖੁਸ਼ੀ ਮਿਲੇ ਮੈਂ ਆਪਣੀ ਕਲਾ ਨੂੰ ਨਿਖਾਰਨ ਦੇ ਲਈ ਬਹੁਤ ਜ਼ਿਆਦਾ ਅਭਿਆਸ ਕਰਦੀ ਹਾਂ ਮੈਂ ਸ਼ੋਸ਼ਲ ਮੀਡੀਆ ਅਖਬਾਰਾਂ ਅਤੇ ਆਮ ਜ਼ਿੰਦਗੀ ਤੋਂ ਪ੍ਰਭਾਵਿਤ ਹੋ ਕੇ ਆਪਣੀ ਕਲਾ ਦਾ ਅਭਿਆਸ ਕਰਦੀ ਹਾਂ